ਸਤਿ ਸ਼੍ਰੀ ਅਕਾਲ ਜੀ ਮੇ ਮੇਰਾ ਨਾਮ ਦੀਪਕ ਆਹੂ ਆ ਅਤੇ ਮੈਂ ਇੱਥੇ ਗੁਰਦਾਸਪੁਰ ਘੁੰਮਣ ਆਇਆ ਦਾ ਇੱਥੇ ਕੋਈ ਕੋਈ ਇਤਿਹਾਸਿਕ ਜਗ੍ਹਾ ਕਿਹੜੀ ਆ ਜੀ ਲਾਗੇ ਸ਼ਾਗੇ ਘੁੰਮਣ ਵਾਲੀ ਇਹ ਕਿੱਥੇ ਇਹ ਛੱਤੀ ਮਿੰਟ ਦਾ ਰਸਤਾ ਇੱਥੋਂ ਅੱਛਾ ਇੱਕ ਘੰਟੇ ਦਾ ਰਸਤਾ ਵਾ ਨਹੀਂ ਬੱਸਾਂ ਜਾਂਦੀਆਂ ਉੱਧਰ ਅੱਛਾ ਬੱਸ ਇੱਥੋਂ ਗੁਰਦਾਸਪੁਰ ਵੱਲ ਨੂੰ ਅੱਛਾ ਜੀ ਠੀਕ ਹੈ ਅਤੇ ਇਹ ਕਿੰਨੀ ਕੁ ਕਿੰਨੀ ਕੁ ਦੂਰ ਹੈਗਾ ਹੈ ਇੱਥੋਂ ਅਤੇ ਇੱਥੇ ਕੀ ਹੈਗਾ ਇੱਥੇ ਖਾਸੀਅਤ ਕੀ ਹੈ ਗੁਰਦੁਆਰੇ ਅੱਛਾ ਅੱਛਾ ਠੀਕ ਹੈ ਅਤੇ ਇੱਕ ਘੰਟੇ ਦਾ ਰਸਤਾ ਇੱਥੋਂ ਅਤੇ ਉਹ ਕਨੈਕਟਰ ਨੂੰ ਉਹ ਕਨੈਕਟਰ ਨੂੰ ਕੀ ਨਾਂ ਲੈਣਾ ਵਾ ਡੇਰਾ ਕੀ ਅੱਛਾ ਅੱਛਾ ਡੇਰਾ ਬਾਬਾ ਨਾਨਕ ਚੱਲੋ ਠੀਕ ਹੈ ਜੀ ਧੰਨਵਾਦ ਤੁਹਾਡਾ